ਸਰ ਵਧੀਆ ਸਰ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਜੀ ਮੈਂ ਸਰ ਇੱਥੇ ਹੀ ਹਾਂ ਕੰਮ ਕਰੀ ਜਾਂਦਾ ਸੀਗਾ ਜੀ ਹਾਂਜੀ ਹਾਂਜੀ ਹਾਂਜੀ ਸਰ ਕੰਮ ਸਰ ਆਪਣਾ ਤਕਰੀਬਨ ਖ਼ਤਮ ਹੋਣ ਵਾਲਾ ਹੀ ਹੈ ਆਪਣਾ ਅਤੇ ਮਿਸਤਰੀ ਲੱਗੇ ਹੋਏ ਹੈ ਅਤੇ ਹਿਸਾਬ ਤਾਂ ਵੈਸੇ ਆਪਣਾ ਸੀਮੈਂਟ ਹੋਰ ਮੰਗਵਾਇਆ ਸੀਗਾ ਘੱਟ ਗਿਆ ਸੀਗਾ ਬਰੇਤੀ ਵਗੈਰਾ ਸ ਸਾਰਾ ਸਰ ਗਿਆ ਉਹ ਸਰ ਹੈ ਹੀ ਹੈ ਘੱਟ ਤੋਂ ਸੌ ਡੇਢ ਸੌ ਗੱਟਾ ਘੱਟ ਗਿਆ ਸੀਗਾ ਜੀ ਆਪਣੇ ਕੋਲ ਨਹੀਂ ਸਰ ਆਪਾਂ ਚਿੱਟੀ ਮੰਗਵਾਈ ਹੈ ਬਰੇਤੀ ਨਹੀਂ ਸਰ ਆਪਣਾ ਫਰਕ ਰੇਟ ਦਾ ਇਹਨਾਂ ਦਾ ਥੋੜ੍ਹਾ ਹੀ ਪੈਂਦਾ ਪਰ ਕੁਆਲਿਟੀ ਮੈਨੂੰ ਵਧੀਆ ਲੱਗੀ ਉਹਨਾਂ ਨਾਲੋਂ ਆਪਣਾ ਚਿੱਟੀ ਦੀ ਸਰ ਨੀਹਾਂ ਨੀਹਾਂ ਸਰ ਆਪਾਂ ਪੱਟੀਆਂ ਦਸ ਦਸ ਫੁੱਟ ਡੂੰਘੀਆਂ ਜੀ ਨਹੀਂ ਪਿੱਲਰ ਪਾ ਪਾਏ ਹੋਏ ਆ ਹਰ ਜਗ੍ਹਾ ਸਭ ਕੀਤਾ ਆਪਾਂ ਜੀ ਪ੍ਰੋਪਰ ਕੰਮ ਕਰਿਆ ਨਹੀਂ ਸਰ ਅਪ ਨਹੀਂ ਸਰ ਆਪਣਾ ਸੀਗਾ ਕੰਮ ਸੀਗਾ ਲੰਬਾ ਤੇ ਤਾਂ ਕਰਕੇ ਸਰ ਆਪਾਂ ਬੋਰ ਹੀ ਕਰਵਾ ਲਿਆ ਸੀਗਾ ਇੱਥੇ ਬੋਰ ਕਰਵਾ ਲਿਆ ਸੀਗਾ ਕਿਉਂਕਿ ਟਾਈਮ ਆਪਾਂ ਨੂੰ ਲੱਗਣਾ ਸੀਗਾ ਕੁਛ ਸਾਲ ਡੇਢ ਸਾਲ ਦਾ ਆਪਣਾ ਕੰਮ ਸੀਗਾ ਡੇਲੀ ਆਪਣਾ ਕੋਈ ਦਿੰਦਾ ਨਹੀਂ ਹੈਗਾ ਜੀ ਬੰਦਾ ਦੋ ਚਾਰ ਦਿਨ ਦੇ ਦੂਗਾ ਹਾਂਜੀ ਹਾਂਜੀ ਹਾਂਜੀ ਸਰ ਉਹ ਮੈਂ ਘੱਟੋ ਘੱਟ ਸੌ ਡੇਢ ਸੌ ਫੁੱਟ ਕਰਵਾਇਆ ਜੀ ਆਪਣਾ ਬੋਰ ਉਹ ਉੱਪਰ ਪਾਣੀ ਮਾੜਾ ਸੀਗਾ ਨੀਚੇ ਚੰਗਾ ਸੀਗਾ ਪਾਣੀ ਹਾਂਜੀ ਹਾਂਜੀ ਛੇ ਛੇ ਇੰਚੀ ਛੇ ਇੰਚੀ ਹਾਂਜੀ ਆ ਹਾਂਜੀ ਹਾਂਜੀ ਹਾਂਜੀ ਸਰ ਕੋਈ ਨਹੀਂ ਹਿਸਾਬ ਉਹਦੇ ਨਾਲ ਮੈਂ ਮਿਸਤਰੀ ਨਾਲ ਅੱਜ ਬਣਾ ਕੇ ਰੱਖ ਲੂਗਾ ਅਤੇ ਆਪਾਂ ਦੋ ਦੋ ਦੋ ਚਾਰ ਦਿਨਾਂ 'ਚ ਇਹਨਾਂ ਨੂੰ ਪੇਮੈਂਟ ਕਰ ਦਾਂਗੇ ਜਦੋਂ ਇਹਨਾਂ ਕੰਮ ਖ਼ਤਮ ਹੋ ਗਿਆ ਉਦੋਂ ਆਪਾਂ ਇਹਨਾਂ ਦੀ ਪੇਮੈਂਟ ਕਰ ਦਾਂਗੇ ਇਲੈਕਟ੍ਰੀ ਦਾ ਸਰ ਨਾਲ ਦੀ ਨਾਲ ਚੱਲ ਰਿਹਾ ਜਿਸ ਤਰ੍ਹਾਂ ਆਪਣਾ ਕੰਪਲੀਟ ਹੋ ਰਹੀ ਹੈ ਆਪਣੀ ਸਾਈਡ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਉੱਨੀ ਥਾਂ ਉਹ ਕੰਮ ਖ਼ਤਮ ਕਰ ਦਿੰਦੇ ਹੈ ਆਪਣਾ ਹਾਂਜੀ ਸਰ ਨਿਬੜਨਾ ਚਾਹੀਦਾ ਹਫ਼ਤੇ 'ਚ ਹੀ ਖ਼ਤਮ ਹੋ ਹੋ ਜੂ ਨਾਈਟੀ ਨਾਈਨ ਪਰਸੈਂਟ ਸਰ ਖ਼ਤਮ ਹੋ ਜੂਗਾ ਆਪਣਾ ਹਫ਼ਤੇ 'ਚ

ਹਾਂਜੀ ਸਰ ਮ ਮੈਨੂੰ ਕੋਲ ਕਰ ਦਿਓ ਕਈ ਵਾਰੀ ਮੈਂ ਦੂਸਰੀ ਸਾਈਡ 'ਤੇ ਗਿਆ ਹੋਵਾਂ ਫਿਰ ਪ੍ਰੋਬਲਮ ਨਾ ਆਵੇ ਆਪਾਂ ਨੂੰ ਤੇ ਮੈਨੂੰ ਕੋਲ ਕਰ ਕਰ ਦਿਓ ਮਾੜਾ ਜਿਹਾ ਓਕੇ ਸਰ ਠੀਕ ਹੈ ਥੈਂਕਯੂ